ਹਾਂਜੀ ਅੱਜ ਕੱਲ੍ਹ ਦੇ ਭੱਜ ਦੌੜ ਦੇ ਸਮੇਂ ਵਿੱਚ ਮਨੁੱਖ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਉਂਦਾ ਜਾਂ ਕਹਿ ਲਓ ਉਸ ਕੋਲ ਇਸ ਵਾਸਤੇ ਸਮਾਂ ਨਿਖੀ ਨਹੀਂ ਕਿਉਂਕਿ ਨੌਕਰੀ ਪੇਸ਼ੇ ਵਿੱਚ ਰੁੱਝਿਆ ਬੰਦਾ ਆਪਣੇ ਰੂਟੀਨ ਦੇ ਕੰਮ ਕਰਕੇ ਮਸਾਂ ਹੀ ਵੇਹਲਾ ਹੁੰਦਾ ਹੈ ਪਰ ਜੇ ਸਾਡੇ ਕੋਲ ਸਮਾਂ ਹੁੰਦਾ ਵੀ ਹੈ ਤਾਂ ਅਸੀਂ ਉਹ ਸਮਾਂ ਫੋਨ 'ਤੇ ਰੀਲਸ ਵੇਖ ਕੇ ਜਾਂ ਯੂਟੀਊਬ 'ਤੇ ਵੀਡੀਓਜ਼ ਵੇਖ ਕੇ ਹੀ ਵਿਅਰਥ ਗੁਆ ਦਿੰਦੇ ਹਾਂ ਪਰ ਮਨੁੱਖ ਨੂੰ ਦੀ ਨੌਕਰੀ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਸਿਹਤ ਜੇ ਅਸੀਂ ਸਿਹਤਮੰਦ ਨਹੀਂ ਹੋਵਾਂਗੇ ਤਾਂ ਕੋਈ ਵੀ ਕੰਮ ਧੰਦਾ ਅਸੀਂ ਚੰਗੀ ਤਰ੍ਹਾਂ ਨਹੀਂ ਕਰ ਪਾਵਾਂਗੇ ਮੈਂ ਆਪਣੀ ਸਿਹਤ ਲਈ ਯੋਗਾ ਅਤੇ ਕਸਰਤਾਂ ਕਰਦੀ ਹਾਂ ਮੇਰਾ ਯੋਗਾ ਵਿੱਚ ਕਾਫੀ ਰੁਝਾਨ ਹੈ ਮੈਨੂੰ ਯੋਗਾ ਕਰਨਾ ਅਤੇ ਦੂਜਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣਾ ਬਹੁਤ ਪਸੰਦ ਹੈ ਇਸ ਕੰਮ ਲਈ ਮੈਂ ਆਪ ਤਾਂ ਯੋਗਾ ਕਰਦੀ ਹੀ ਹਾਂ ਲੋਕਾਂ ਨੂੰ ਵੀ ਇਸ ਬਾਰੇ ਸੁਚੇਤ ਕਰ ਰਹੀ ਹਾਂ ਇਸ ਕੰਮ ਲਈ ਮੈਂ ਯੋਗਾ ਦੇ ਨਾਲ ਸੰਬੰਧਿਤ ਔਨਲਾਈਨ ਕਲਾਸਾਂ ਲਗਾਉਂਦੀ ਹਾਂ ਜਾਂ ਯੋਗਾ ਅਤੇ ਕਸਰਤਾਂ ਦੀਆਂ ਵੀਡੀਓ ਬਣਾ ਬਣਾ ਕੇ ਵਟਸਐਪ ਰਾਹੀਂ ਮਲਟੀਮੀਡੀਆ ਰਾਹੀਂ ਵੱਖ ਵੱਖ ਗਰੁੱਪਾਂ ਵਿੱਚ ਸ਼ੇਅਰ ਕਰ ਦਿੰਦੀ ਹਾਂ ਜੋ ਮੇਰੇ ਨਾਲ ਮੇਰੇ ਦੋਸਤ ਮਿੱਤਰ ਪਰਿਵਾਰਿਕ ਮੈਂਬਰ ਫੋਨ ਦੇ ਰਾਹੀਂ ਜੁੜੇ ਹੋਏ ਹਨ ਫੋਨ ਰਾਹੀਂ ਮੈਂ ਉਹਨਾਂ ਨੂੰ ਇਹ ਸਾਰੀਆਂ ਵੀਡੀਓ ਭੇਜ ਦਿੰਨੀਆਂ ਨੇ ਦਿੰਦੀ ਹਾਂ ਅਤੇ ਉਹ ਇਹਨਾਂ ਦਾ ਲਾਭ ਉਠਾਉਂਦੇ ਹਨ ਹਾਂਜੀ ਮੇਰਾ ਰੋਜ਼ਾਨਾ ਚੰਗੀ ਸਿਹਤ ਦਾ ਟੀਚਾ ਹੈ ਕਿ ਮੈਂ ਹਰ ਰੋਜ਼ ਇੱਕ ਘੰਟਾ ਆਪ ਯੋਗਾ ਅਤੇ ਕਸਰਤਾਂ ਕਰਦੀ ਹਾਂ ਅਤੇ ਆਪਣੇ ਸਾਥੀਆਂ ਨੂੰ ਵੀ ਕਰਵਾਉਂਦੀ ਹਾਂ ਅਤੇ ਤਾਂ ਜੋ ਉਹ ਤੰਦਰੁਸਤ ਰਹਿ ਸਕਣ